ਹੈਲੋ ਹਾਂਜੀ ਭਾਅ ਜੀ ਤੁਸੀਂ ਕਿੱਥੇ ਖੜ੍ਹੇ ਹੋ ਇਸ ਟਾਈਮ 'ਤੇ ਮੈਂ ਤੁਹਾਨੂੰ ਇੱਕ ਘੰਟਾ ਪਹਿਲਾਂ ਇੱਕ ਬੁੱਕ ਕਰਵਾਈ ਸੀ ਓਲਾ ਕੈਬ ਜਿਹਦੇ ਕਰਕੇ ਕਿ ਮੈਨੂੰ ਕਿਸੇ ਜਗ੍ਹਾ 'ਤੇ ਜਾਣਾ ਸੀ ਦੇਖੋ ਮੇਰੇ ਘਰਦੇ ਵੀ ਮੇਰੇ ਨਾਲ ਬਹੁਤ ਲੜਾਈ ਝਗੜਾ ਕਰ ਰਹੇ ਨੇ ਕਿ ਤੁਸੀਂ ਜਿੱਥੇ ਜਾਣਾ ਸੀ ਉੱਥੇ ਅਸੀਂ ਲੇਟ ਹੋ ਚੁੱਕੇ ਹਾਂ ਮੇਰੇ ਖਿਆਲ 'ਚ ਮੈਂ ਤੁਹਾਨੂੰ ਘੰਟਾ ਪਹਿਲਾਂ ਫੋਨ ਕਰਕੇ ਓਲਾ ਬੁੱਕ ਕਰਵਾਈ ਸੀ ਪਰ ਉਹ ਹਾਲੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਹੈ ਅਤੇ ਮੈਂ ਤਾਂ ਆਪਣੇ ਕੰਮ ਤੋਂ ਵੀ ਲੇਟ ਹੋ ਰਹੀ ਹਾਂ ਇਹਦੇ ਕਰਕੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੰਨੀ ਅੱਛੀ ਸਰਵਿਸ ਦੇ ਰਹੇ ਹੋ ਅਤੇ ਮੈਨੂੰ ਹੁਣ ਜਿੱਥੇ ਤੁਸੀਂ ਹੋ ਉੱਥੋਂ ਕਿੰਨੀ ਕੁ ਦੇਰ ਤੱਕ ਆ ਜਾਉਂਗੇ ਇਸ ਬਾਰੇ ਮੈਨੂੰ ਜਾਣਕਾਰੀ ਦਿਉ ਤਾਂ ਕਿ ਮੈਨੂੰ ਲਾਰੇ ਨਾ ਲਾਉ ਤੁਸੀਂ ਔਰ ਜਿੱਥੇ ਮੈਂ ਪਹੁੰਚਣਾ ਮੈਂ ਸਮੇਂ ਸਿਰ ਪਹੁੰਚ ਸਕਾਂ ਉੱਥੇ